ਜੇਕਰ ਇਕਰਾਰਨਾਮੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਾਫੀ ਤਰ੍ਹਾਂ ਦੇ ਐਗਰੀਮੈਂਟਸ ਹੁੰਦੇ ਐ ਮਿਊਚਲ ਐਗਰੀਮੈਂਟਸ ਹੁੰਦੇ ਆ ਜਿਹੜੇ ਕਿ ਸ ਪ੍ਰੋਪਰਟੀ ਸੈਲਿੰਗ ਦੇ ਨਾਲ ਰਿਲੇਟਡ ਕਿ ਦੋਵਾਂ ਪੱਖਾਂ ਵੱਲੋਂ ਉਸ ਚੀਜ਼ 'ਤੇ ਐਗਰੀ ਕੀਤਾ ਜਾ ਰਿਹਾ ਹੈ ਕਿ ਇੱਕ ਵੇਚਣਾ ਚਾਹੁੰਦਾ ਆ ਅਤੇ ਇੱਕ ਖਰੀਦਣਾ ਚਾਹੁੰਦਾ ਹੈ ਫਿਰ ਉਸ ਪ੍ਰੋਪਰਟੀ 'ਤੇ ਸਰਕਾਰੀ ਦਸਤਖਤ ਵਗੈਰਾ ਲੋਇਰ ਦੇ ਸਾਹਮਣੇ ਕੀਤੇ ਜਾਂਦੇ ਹਨ ਤਾਂ ਕਿ ਦੋਵੇਂ ਉਸ ਚੀਜ਼ ਦੇ ਉੱਤੇ ਸਹਿਮਤ ਹਨ ਫਿਰ ਉਸਨੂੰ ਕੋਰਟ ਵਿੱਚ ਜਮ੍ਹਾਂ ਕਰਕੇ ਲਾਗੂ ਕੀਤਾ ਜਾਂਦਾ ਹੈ ਜਿੱਥੋਂ ਤੱਕ ਮੇਰੀ ਨੌਲੇਜ ਦੇ ਵਿੱਚ ਹੈ ਉਸ ਤੋਂ ਬਾਅਦ ਇੰਡਵਿਜੁਅਲ ਪੱਧਰ 'ਤੇ ਉਹਨਾਂ ਦੋਨਾਂ ਪੱਖਾਂ ਵੱਲੋਂ ਡੈਕਲਾਰੇਸ਼ਨ ਜਾਂ ਐਫੀਡੈਵਿਟ ਵਕੀਲ ਦੀ ਸਹਾਇਤਾ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਬਾਅਦ ਵਿੱਚ ਜੇਕਰ ਕੋਈ ਆਪਣੀ ਗੱਲ ਤੋਂ ਪਿੱਛੇ ਵੀ ਹਟਦਾ ਹੈ ਤਾਂ ਉਸ ਚੀਜ਼ ਨੂੰ ਐਜ ਆ ਪਰੂਫ ਰੱਖਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਉਸਦੇ ਦਸਤਖਤ ਕਰਕੇ ਆਪਣੀ ਮਨਜ਼ੂਰੀ ਦਿੱਤੀ ਗਈ ਹੈ